ਮੇਰੀ ਮਨਪਸੰਦ ਫੋਟੋ ਕਰਾ ਕੋਈ ਇੱਕ ਨਹੀਂ ਅਸਲ ਵਿੱਚ ਕਈ ਸਾਰੀਆਂ ਅਜਿਹੀਆਂ ਫੋਟੋਆਂ ਤਸਵੀਰਾਂ ਹਨ ਜਿਹੜੀਆਂ ਕਿ ਮੈਨੂੰ ਬਹੁਤ ਪਸੰਦ ਹਨ ਅਤੇ ਉਹ ਤਸਵੀਰਾਂ ਅੱਜ ਵੀ ਮੇਰੇ ਫੋਨ ਦੀ ਗੈਲਰੀ ਦੇ ਵਿੱਚ ਕੈਦ ਹਨ ਜਿਵੇਂ ਕਿ ਕੁਝ ਕੁ ਦਿਨ ਪਹਿਲਾਂ ਦੀ ਗੱਲ ਹੈ ਸ਼ਾਮ ਜਿਹੀ ਦਾ ਵਕਤ ਸੀ ਅਤੇ ਸੂਰਜ ਢਲ ਰਿਹਾ ਸੀ ਮੈਂ ਯੂਨੀਵਰਸਿਟੀ ਮੇਨ ਕੈਂਪਸ ਤੋਂ ਆਪਣੇ ਹੋਸਟਲ ਲਈ ਜਾ ਰਹੀ ਸੀ ਤਾਂ ਜਦੋਂ ਹੀ ਮੈਂ ਸੂਰਜ ਨੂੰ ਢਲਦੇ ਦੇਖਿਆ ਸ਼ਾਮਾਂ ਢਲ ਚੁੱਕੀਆਂ ਸਨ ਇੱਕ ਠੰਡਾ ਜਾਂ ਮੌਸਮ ਸੀ ਤਾਂ ਕੁਦਰਤ ਇੰਝ ਲੱਗਦਾ ਸੀ ਬੜੀ ਹੀ ਉਸ ਦਿਨ ਖੁਸ਼ ਸੀ ਤਾਂ ਮੈਂ ਉਸ ਦਿਨ ਫੋਟੋ ਖਿੱਚੀ ਸੀ ਤਾਂ ਇਸ ਤੋਂ ਇਲਾਵਾ ਇੱਕ ਦਿਨ ਪਾਣੀ ਵਗ ਰਿਹਾ ਸੀ ਪਾਣੀ ਵਗਦੇ ਦੇ ਕੋਲ ਮੈਂ ਅਤੇ ਮੇਰੀ ਮਿੱਤਰ ਦੋਨੋਂ ਅਸੀਂ ਜਾ ਰਹੀਆਂ ਸੀ ਤਾਂ ਮੈਨੂੰ ਕੁਦਰਤ ਨਾਲ ਇੰਨਾ ਕੁ ਪਿਆਰ ਹੈ ਕਿ ਜਿਵੇਂ ਹਰਿਆਲੀ ਹੈ ਫੁੱਲ ਖਿੜ੍ਹੇ ਹੋਏ ਨੇ ਅਤੇ ਕੋਲ ਪਾਣੀ ਵੱਗ ਰਿਹਾ ਸੀ ਤਾਂ ਮੈਂ ਉਸ ਦ੍ਰਿਸ਼ ਨੂੰ ਕੈਦ ਕਰੇ ਬਿਨਾਂ ਨਹੀਂ ਰਹਿ ਸਕੀ ਤਾਂ ਉਸ ਦਿਨ ਮੈਂ ਅਤੇ ਮੇਰੀ ਦੋਸਤ ਦੋਨਾਂ ਨੇ ਜੋ ਸੀ ਉਹ ਵਗਦੇ ਹੋਏ ਪਾਣੀ ਦੀ ਜਿਹੜੀ ਫੋਟੋ ਲਈ ਸੀ